ਸਤਿ ਸ਼੍ਰੀ ਅਕਾਲ ਜੀ ਮੈਂ ਕੇਲ ਕੋਲ ਇਸ ਲਈ ਕੀਤੀ ਹੈ ਕਿਉਂਕਿ ਅੱਜ ਸਵੇਰੇ ਮੈਂ ਤੁ ਤੁਹਾਡੇ ਇੱਕ ਰੇਲ ਗੱਡੀ ਵਿੱਚ ਯਾਤਰਾ ਕੀਤੀ ਜਿਸ ਦਾ ਅਨੁਭਵ ਬਹੁਤ ਹੀ ਚੰਗਾ ਰਿਹਾ ਸਭ ਤੋਂ ਪਹਿਲਾਂ ਤਾਂ ਰੇਲਵੇ ਰੇਲ ਗੱਡੀ ਵਿੱਚ ਕਾਫੀ ਸਫਾਈ ਸੀ ਜੋ ਕਿ ਅੰਤਰ ਰੇਲ ਗੱਡੀ ਵਿੱਚ ਨਹੀਂ ਦੇਖਣ ਨੂੰ ਮਿਲਦੀ ਦੂਸਰਾ ਰੇਲ ਗੱਡੀ ਪੂਰੇ ਸਮੇਂ 'ਤੇ ਆਈ ਅਤੇ ਜੇ ਜਿਸ ਜਿਸ ਜੋ ਸਮਾਂ ਤੈਅ ਕੀਤਾ ਗਿਆ ਸੀ ਉਸੇ ਸਮੇਂ 'ਤੇ ਜਗ੍ਹਾ ਆਪਣੀ ਜਗ੍ਹਾ 'ਤੇ ਪਹੁੰਚੀ ਇਸ ਤੋਂ ਇਲਾਵਾ ਜੋ ਸ ਸਟਾਫ ਜੋ ਸੇਵਾਦਾਰ ਸਾਰੇ ਰੇ ਰੇਲ ਗੱਡੀ ਵਿੱਚ ਮੌਜੂਦ ਸਨ ਸਾਰਿਆਂ ਦਾ ਵਿਹਾਰ ਕਾਫੀ ਵਧੀਆ ਸੀ ਅਤੇ ਖਾਣ ਪੀਣ ਦਾ ਸਮਾਨ ਵੀ ਕਾਫੀ ਸਾਫ ਸੁਥਰਾ ਅਤੇ ਸਿਹਤਮੰਦ ਲੱਗਾ ਤਾਜ਼ਾ ਵੀ ਸੀ ਇਸ ਤੋਂ ਇਲਾਵਾ ਜੋ ਟਿਕਟ ਦੇ ਭਾਅ ਸੀ ਉਹ ਵੀ ਕਾਫੀ ਵਾਜਿਬ ਸਨ ਇਹ ਸਭ ਚੀਜ਼ਾਂ ਮੈਨੂੰ ਰੇਲ ਗੱਡੀ ਯਾਤਰਾ ਕਰਨ ਦੌਰਾਨ ਕਾਫੀ ਚੰਗੀਆਂ ਲੱਗੀਆਂ ਧੰਨਵਾਦ